ਹੈਲੋ ਹਾਂ ਹਾਂ ਕਿਵੇਂ ਆ ਰਾਹੁਲ ਹਾਂ ਹਾਂ ਵਧੀਆ ਤੂੰ ਸੁਣਾ ਘਰੇ ਸਬ ਵਧੀਆ ਹਾਂ ਹਾਂ ਵਧੀਆ ਤੂੰ ਸੁਣਾ ਮੰਮੀ ਡੈਡੀ ਵਧੀਆ ਤੇਰੇ ਬਸ ਕੁਛ ਨਹੀਂ ਵੇਹਲੇ ਬਸ ਜੋਬ ਦੀ ਤਿਆਰੀ ਭਾਲ ਚ ਆ ਹਾਂਜੀ ਨਹੀਂ ਨਹੀਂ ਹਾਲੇ ਤਾਂ ਤਿਆਰੀ ਚ ਹਾਂ ਕਿ ਕੋਈ ਨਾ ਕੋਈ ਲੱਭ ਰਿਹਾ ਜੋਬ ਕੋਈ ਲੱਭੇ ਜੋਬ ਤੇ ਹਾਲੇ ਜੋਬ ਲਈ ਇਗਜ਼ਾਮ ਦੀ ਤਿਆਰੀ ਕਰ ਰਿਹਾ ਮੈਂ ਤਾਂ ਹਾਂਜੀ ਆ ਜੋਬਸ ਆ ਰਹੀਆਂ ਨੇ ਆਪਣੇ ਪੰਜਾਬ ਦੇ ਵਿੱਚ ਹੀ ਫਿਰੋਜਪੁਰ ਵਿੱਚ ਵੀ ਆਈਆਂ ਨੇ ਪੰਜਾਬ ਪੁਲਿਸ ਵਗੈਰਾ ਤੇ ਇੰਡੀਅਨ ਆਰਮੀ ਦੀ ਤੇ ਹੋਰ ਬੈਂਕ ਦੇ ਵਿੱਚ ਓਪੋਰਚੁਨਿਟੀ ਵਾਸਤੇ ਆਈਆਂ ਹੋਈਆਂ ਨੇ ਹਾਂ ਹਾਂ ਤੇ ਤੂੰ ਚਲੋ ਕੋਈ ਨਹੀਂ ਤੂੰ ਤਿਆਰੀ ਕਰ ਤੇ ਆਪਣਾ ਜਦੋਂ ਆ ਜਾਏਗੀ ਡੇਟ ਇਗਜ਼ਾਮ ਦੀ ਤੇ ਫਿਰ ਤੂੰ ਐਗਜ਼ਾਮ ਦੇਣ ਚਲਾ ਜਾਈ ਹਾਂ ਹਾਂ ਮੈਂ ਤਾਂ ਤਿਆਰੀ ਕਰ ਰਿਹਾ ਮੈਂ ਆਪਣੇ ਇੰਡੀਅਨ ਆਰਮੀ ਦੀ ਤਿਆਰੀ ਕਰ ਰਿਹਾ ਤੇ ਇੱਕ ਆਪਣੇ ਪੰਜਾਬ ਪੁਲਿਸ ਉਸ ਦੇ ਇਗਜ਼ਾਮ ਦੀ ਤਿਆਰੀ ਕਰਦਾ ਪਿਆ ਆਪਣੇ ਫਿਰੋਜਪੁਰ ਦੇ ਵਿੱਚ ਕਰ ਰਿਹਾ ਮੈਂ ਤਾਂ ਤਿਆਰੀ ਉੱਥੇ ਇੰਸਟੀਚਿਊਟ ਦੇ ਵਿੱਚ ਅੱਛਾ ਅੱਛਾ ਕੋਈ ਨਹੀਂ ਫਿਰ ਜੇ ਤਿਆਰੀ ਚ ਤਾਂ ਫਿਰ ਕੋਈ ਨਹੀਂ ਆਪਣੀ ਤਿਆਰੀ ਸ਼ੁਰੂ ਕਰਦੇ ਐਗਜ਼ਾਮ ਦੀ ਆਈਬੀਟੀ ਇੰਸਟੀਚਿਊਟ ਹੈਗਾ ਆਪਣੇ ਮੁਲਤਾਨੀ ਗੇਟ ਦੇ ਕੋਲ ਆਪਣਾ ਮੁਲਤਾਨੀ ਗੇਟ ਦੇ ਕੋਲ ਹੀ ਆਪਣਾ ਇੰਸਟੀਟਿਊਟ ਹੈ ਮੈਡੀਸਿਟੀ ਹੋਸਪਿਟਲ ਦੇ ਕੋਲ ਆਈਬੀਟੀ ਇੰਸਟੀਚਿਊਟ ਤੇ ਉੱਥੇ ਬੜੀ ਵਧੀਆ ਤਿਆਰੀ ਕਰਾਉਂਦੇ ਨੇ ਜੋਬਸ ਵਗੈਰਾ ਦੀ ਆਪਣੀ ਫਿਰੋਜਪੁਰ ਦੇ ਵਿੱਚ ਹੀ ਹਾਂ ਹਾਂ ਕੋਈ ਹੋਰ ਫਿਰ ਉਹਦੇ ਸਾਹਮਣੇ ਹੈਗਾ ਅੱਡਾ ਪੰਜਾਬ ਵੱਡਾ ਟਵੇਂਟੀ ਫੌਰ ਹਾਂ ਪੰਜਾਬ ਪੁਲਿਸ ਜੇ ਕੋਈ ਹੋਰ ਵੀ ਆਪਣੇ ਜੋਬਸ ਕੋਈ ਵੀ ਆਈਆਂ ਹੁਣ ਆਪਣੇ ਫਿਰੋਜਪੁਰ ਦੀਆਂ ਨਾਲ ਸਭ ਦੀ ਤਿਆਰੀ ਕਰਾਉਂਦੇ ਨੇ ਕਿਸੇ ਦੀ ਤਿਆਰੀ ਕਰ ਸਕਦੇ ਜੋਬਸ ਦੀ ਹਾਂ ਹਾਂ ਕੰਪਿਊਟਰ ਬੇਸ ਫਿਰ ਜੇ ਬੈਂਕ ਦੀ ਤਿਆਰੀ ਕਰਨੀ ਉਹ ਵੀ ਕਰ ਸਕਦੇ ਤੁਸੀਂ ਕੰਪਿਊਟਰ ਬੇਸ ਹਾਂ ਹਾਂ ਬੈਂਕ ਦੇ ਵੀ ਆਈ ਹੋਈ ਜੋਬ ਆਪਣੇ ਮੰਗ ਰਹੇ ਨੇ ਆਪਣੇ ਬੀਏ ਮੰਗ ਰਹੇ ਨੇ ਹਾਂ ਬੀਏ ਦੇ ਬੇਸ ਤੇ ਆਈ ਹੋਈ ਹੈ ਕਿਸੇ ਵੀ ਕੋਈ ਡਿਗਰੀ ਹੋਵੇ ਆਪਣੀ ਕੋਈ ਵੀ ਕੋਈ ਆਪਣੇ ਕੋਲ ਰਿਕਾਇਰਮੈਂਟ ਨਹੀਂ ਨਹੀਂ ਬੀ ਏ ਓਨਲੀ ਬੀ ਏ ਬਸ ਹਾਂ ਬਸ ਇਹਨਾ ਹੈ ਕਿ ਬਸ ਬੇਸਿਕ ਚੀਜ਼ਾਂ ਪਤਾ ਹੋਣਾ ਆਪਾਂ ਨੂੰ ਕੰਪਿਊਟਰ ਦੀਆਂ ਹਾਂਜੀ ਆਪਣੇ ਹਾਂ ਕੰਪਿਊਟਰ ਸੈਂਟਰ ਫ਼ਿਰੋਜਪੁਰ ਕੈਨੇਡਾ ਵਿੱਚ ਹੈਗਾ ਏਬੀਸੀ ਸਰਕਾਰੀ ਵੀ ਹੈਗਾ ਆਪਣੇ ਉਹ ਆਪਣੇ ਉਧਮ ਸਿੰਘ ਚੋਂਕ ਕੋਲ ਹੈਗਾ ਆਪਣੇ ਫਿਰੋਜਪੁਰ ਦੇ ਵਿੱਚ ਹਾਂ ਫੀਸ ਦਿਖਾਉਂਦੇ ਨੇ ਆਪਣੇ ਜਿਹੜੇ ਐਸਟੀ ਕੈਟਾਗਰੀ ਉਹਨਾਂ ਵਾਸਤੇ ਬਿਲਕੁਲ ਫਰੀ ਆਫ ਕੋਸਟ ਹੈ ਤੇ ਉਹਨਾਂ ਦੀ ਸਕੋਲਰਸ਼ਿਪ ਵੀ ਆ ਜਾਂਦੀ ਹੈ ਹਾਂਜੀ ਹਾਂਜੀ ਕੰਪਿਊਟਰ ਸੈਂਟਰ ਦੇ ਵਿੱਚ ਉਸ ਦੇ ਟੀਚਰ ਵੀ ਬਹੁਤ ਵਧੀਆ ਨੇ ਹਾਂ ਹਾਂ ਬੇਸਿਕ ਨੌਲਜ ਲੈਣੀ ਹੈਗੀ ਆਪਣਾ ਕੋਈ ਗਹਾਂ ਹੋਰ ਵੀ ਡੀਪਲੀ ਜਾਂ ਨੌਲੇਜ ਲੈਣੀ ਹੈ ਅੱਛਾ ਅੱਛਾ ਚਲ ਅੱਛਾ ਅੱਛਾ ਹਾਂ ਹਾਂ ਉਹੀ ਰੱਖਦੇ ਨੇ ਚਲੋ ਉਧਮ ਸਿੰਘ ਚੋਂਕ ਦੇ ਕੋਲ ਆਪਣੇ ਫਿਰੋਜਪੁਰ ਦੇ ਵਿੱਚ ਉੱਧਮ ਸਿੰਘ ਚੋਂਕ ਹੈ ਨੇ ਜਿਹੜਾ ਤੇ ਜਦੋਂ ਆਪਾਂ ਫਿਰੋਜਪੁਰ ਕੈਂਟਮ ਜਾਈਦਾ ਉਸੇ ਰੋਡ ਦੇ ਵਿੱਚ ਹੈਗਾ ਹਾਂ ਬਾਗੀ ਹੋਸਪਿਟਲ ਸਾਇਡ ਹਾਂ ਆਹ ਫਰੀ ਆਫ ਕੋਸਟ ਹੀ ਹੈ ਕਿਉਂਕਿ ਗਵਰਮੈਂਟ ਕੰਪਿਊਟਰ ਸੈਂਟਰ ਨਾਲ ਹਾਂ ਬਸ ਵਧੀਆ ਹਾਂ ਹਾਂ ਮੇਰੀ ਤਾਂ ਤਿਆਰੀ ਚੱਲੀ ਜਾਂਦੀ ਬਸ ਵਧੀਆ ਬਸ ਹੋਰ ਕੋਈ ਇੱਕ ਦੋ ਮਹੀਨੇ ਲਾ ਕੇ ਤੇ ਫਿਰ ਤਾਂ ਆਪਣੀ ਪੂਰੀ ਤਿਆਰੀ ਹੋ ਜਾਣੀ ਹੈ ਬਸ ਇੱਕ ਵਾਰੀ ਤਿਆਰੀ ਹੋਈ ਪਈ ਹੈ ਬਸ ਉਹ ਰਿਪੀਟ ਤਿਆਰੀ ਕੀਤੀ ਜਾ ਨਾ ਜੋਬਸ ਲਈ ਆਪਣੇ ਫਿਰੋਜਪੁਰ ਦੇ ਵਿੱਚ ਹੀ ਤੇ ਬਸ ਹਾਂ ਮੈਂ ਤੇ ਉਹੀ ਕਹਿਣਾ ਕਿ ਜੇ ਕੋਈ ਆਪਣੇ ਇੱਥੋਂ ਦੀ ਕੋਈ ਫਿਰੋਜਪੁਰ ਦੀ ਜੋਬ ਆਵੇ ਤੇ ਆਪਾਂ ਫਿਰੋਜਪੁਰ ਦੇ ਵਿੱਚ ਜੋਬ ਕਰਨ ਲੱਗਦੇ ਜੀ ਆਪਾਂ ਦੂਰ ਕਿਸੇ ਹੋਰ ਸਟੇਟ ਵਗੈਰਾ ਜਾਣ ਦੀ ਲੋੜ ਹੀ ਨਾ ਪਵੇ ਜਾ ਹਾਂ ਹਾਂ ਬਸ ਚੰਗੀ ਜੋਬ ਲੱਗ ਜਾਏ ਤੇ ਬਸ ਇਨਾ ਹੀ ਹੋਰ ਆਪਾਂ ਹੋਰ ਕੀ ਚਾਹੀਦਾ ਹਾਂ ਚਲੋ ਵਧੀਆ ਹੋਰ ਹਾਂ ਹਾਂ ਆਹ ਵਧੀਆ ਵਧੀਆ ਸਭ ਵਧੀਆ ਚੱਲ ਰਿਹਾ ਬਸ ਹਾਂ ਚਲੋ ਠੀਕ ਹੈ ਠੀਕ